ਹੈਲੋ ਮੈਂ ਨਾ ਦਿੱਲੀ ਤੋਂ ਆਈ ਸੀਗੀ ਤੇ ਫਾਜਿਲਕਾ ਦੇ ਵਿੱਚ ਆਪਣੇ ਚ ਐਥੇ ਵਧੀਆ ਤੋਂ ਵਧੀਆ ਰੈਸਟੋਰੈਂਟ ਕਿਹੜੇ ਹੈਗੇ ਨੇ ਨਈਂ ਮੈਂ ਦੋ ਦਿਨ ਲਗਾਨੇ ਨੇ ਐਥੇ ਹਾਂਜੀ ਠੀਕ ਐ ਠੀਕ ਐ ਹਾਂਜੀ ਹਾਂਜੀ ਠੀਕ ਐ ਠੀਕ ਐ ਨਈਂ ਖਾਣਾ ਵਗੈਰਾ ਓਥੇ ਵਧੀਆ ਹੋਵੇ ਬਹੁਤ ਜਿਆਦਾ ਵਧੀਆ ਹੋਵੇ ਠੀਕ ਹਾਂਜੀ ਹਾਂਜੀ ਠੀਕ ਐ ਪਿਓਰ ਵੈਜੀਟੇਰੀਅਨ ਵਗੈਰਾ ਅਸੀਂ ਜਿਆਦਾ ਲਾਈਕ ਕਰਦੇ ਆਂ ਠੀਕ ਐ ਜੀ

ਨਈਂ ਆਪਾਂ ਨੂੰ ਕੋਈ ਡਿਸਕਾਊਂਟ ਵਗੈਰਾ ਵੀ ਮਿਲੇਗਾ ਕੁਛ ਠੀਕ ਐ

ਠੀਕ ਐ ਅੱਛਾ ਜੀ ਠੀਕ ਐ ਅੱਛਾ ਅੱਛਾ ਅੱਛਾ ਜੀ ਠੀਕ ਐ ਅੱਛਾ ਅੱਛਾ ਠੀਕ ਐ ਜੀ ਠੀਕ ਐ ਚਲੋ ਫਾਜ਼ਿਲਕੇ ਆ ਕੇ ਕੋਨਟੈਕਟ ਕਰਨੇ ਆਂ ਫੇਰ ਹੈਂ ਜੀ ਠੀਕ ਐ ਜੀ ਠੀਕ ਐ ਓਕੇ